ਨਵੇਂ ਪਕਵਾਨ ਸਿੱਖਣ ਲਈ ਮੈਂ ਜ਼ਿਆਦਾਤਰ ਯੂਟਿਊਬ ਵੀਡੀਓ ਦੀ ਹੀ ਵਰਤੋਂ ਕਰਦੀ ਹਾਂ ਕਿਉਂਕਿ ਯੂਟਿਊਬ ਵਿੱਚ ਜਦੋਂ ਅਸੀਂ ਆਪਣੀ ਕਿਸੇ ਵੀ ਮਨਪਸੰਦ ਰੈਸਪੀ ਦੀ ਵੀਡੀਓ ਦੇਖਦੇ ਹਾਂ ਤਾਂ ਅਸੀਂ ਉਹਨੂੰ ਰੋਕ ਕੇ ਪੌਜ਼ ਵੀ ਕਰ ਸਕਦੇ ਹਾਂ ਅਤੇ ਉਹਨੂੰ ਦੁਬਾਰਾ ਚਲਾ ਵੀ ਸਕਦੇ ਹਾਂ ਜਦੋਂ ਕਿ ਟੀ ਵੀ ਸ਼ੋ ਹੁੰਦਾ ਹੈ ਜਿਹੜਾ ਉਹ ਲਾਈਵ ਚੱਲਦਾ ਹੈ ਅਤੇ ਉਹ ਜੇਕਰ ਕੋਈ ਚੀਜ਼ ਸਾਡੇ ਤੋਂ ਛੁੱਟ ਜਾਂਦੀ ਹੈ ਤਾਂ ਉਹ ਦੁਬਾਰਾ ਅਸੀਂ ਨਹੀਂ ਦੇਖ ਸਕਦੇ ਪਰ ਯੂਟਿਊਬ ਵਿੱਚ ਐਦਾਂ ਦਾ ਕੁਝ ਨਹੀਂ ਹੁੰਦਾ ਯੂਟਿਊਬ ਵਿੱਚ ਜਦੋਂ ਮਰਜ਼ੀ ਅਸੀਂ ਜਦ ਮਰਜ਼ੀ ਅਸੀਂ ਯੂਟਿਊਬ 'ਤੇ ਕੋਈ ਵੀ ਰੈਸਪੀ ਦੇਖ ਸਕਦੇ ਹਾਂ ਜਦੋਂ ਵੀ ਸਾਡਾ ਦਿਲ ਕਰਦਾ ਹੈ ਅਸੀਂ ਯੂਟਿਊਬ ਖੋ ਖੋਲ੍ਹ ਕੇ ਕੋਈ ਵੀ ਰੈਸਪੀ ਦੀ ਪਾਲਣਾ ਕਰ ਸਕਦੇ ਹਾਂ ਅਤੇ ਇਹ ਸਾਨੂੰ ਵਧੀਆ ਲੱਗਦੀ ਹੈ